ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਛ ਅਜਿਹੇ ਵਿਸ਼ੇ ਹਨ ਜਿਹਨਾਂ ਬਾਰੇ ਮੈਂ ਲਿਖਣਾ ਚਾਹੁੰਦੀ ਹਾਂ ਪਰ ਮੈਂ ਹਾਲੇ ਤੱਕ ਲਿਖਿਆ ਨਹੀਂ ਹੈ ਪਰ ਮੈਂ ਕੁੜੀਆਂ ਦੀ ਸੁਰੱਖਿਆ 'ਤੇ ਲਿਖਣਾ ਚਾਹੁੰਦੀ ਹਾਂ ਜਿਵੇਂ ਕਿ ਕੁੜੀਆਂ ਨੂੰ ਬੁਰੇ ਵਿਵਹਾਰ ਅਤੇ ਚੰਗੇ ਵਿਵਹਾਰ ਬਾਰੇ ਪਤਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਇਸੀ ਤਰ੍ਹਾਂ ਜਦੋਂ ਕੁੜੀਆਂ ਜਵਾਨ ਹੁੰਦੀਆਂ ਹਨ ਤਾਂ ਉਹਨਾਂ ਨੂੰ ਮਹੀਨਾ ਮਹੀਨੇ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਇਹਨਾਂ ਮਹੀਨਿਆਂ ਦੀ ਜਾਣਕਾਰੀ ਕੁੜੀਆਂ ਨੂੰ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ ਕਿਉਂ ਇਹ ਹੈ ਮਾਂ ਪਿਓ ਨੂੰ ਚਾਹੀਦਾ ਹੈ ਕਿ ਉਹਨਾਂ ਨੂੰ ਇਹ ਇਸ ਚੀਜ਼ ਬਾਰੇ ਪਹਿਲਾਂ ਹੀ ਦੱਸਣ ਕਿ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਜੋ ਕੁੜੀਆਂ ਪਰੇਸ਼ਾਨ ਨਾ ਹੋਣ ਤਣਾਅ ਨਾ ਲੈਣ ਟੈਂਸ਼ਨ ਵਿੱਚ ਨਾ ਆ ਜਾਣ ਇਸ ਕਰਕੇ ਉਹਨਾਂ ਨੂੰ ਇਸ ਚੀਜ਼ ਦੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਜੋ ਉਹ ਅੱਗੇ ਜਾ ਕੇ ਆਪਣੇ ਆਪ ਨੂੰ ਸੰਭਾਲ ਸਕਣ ਇਸ ਲਈ ਮੈਂ ਇਸ ਚੀਜ਼ 'ਤੇ ਜ਼ਰੂਰ ਲਿਖਣਾ ਚਾਹੁੰਦੀ ਹਾਂ ਤਾਂ ਕਿ ਕੁੜੀਆਂ ਜੋ ਹੈ ਉਹ ਆਪਣੇ ਆਪ ਨੂੰ ਪਹਿਲਾਂ ਹੀ ਉਸ ਚੀਜ਼ ਵਾਸਤੇ ਤਿਆਰ ਰੱਖਣ ਤਿਆਰ ਰੱਖ ਲੈਣ ਅਤੇ ਪਰੇਸ਼ਾਨ ਨਾ ਹੋਣ ਕਿਉਂਕਿ ਇਹ ਜੋ ਦਿਨ ਹੁੰਦੇ ਹਨ ਇਹਨਾਂ ਵਿੱਚ ਬੱਚੇ ਬਹੁਤ ਘਬਰਾ ਜਾਂਦੇ ਹਨ ਅਤੇ ਉਹ ਹੈ ਆਪਣੇ ਆਪ ਨੂੰ ਖਤਮ ਕਰਨ ਬਾਰੇ ਵੀ ਸੋਚ ਲੈਂਦੇ ਹਨ ਕਿਉਂਕਿ ਉਹ ਦਿਨ ਹੀ ਇਹੋ ਜਿਹੇ ਆਉਂਦੇ ਹਨ ਉਹਨਾਂ ਨੂੰ ਨਹੀਂ ਪਤਾ ਹੁੰਦਾ ਉਹਨਾਂ ਬਾਰੇ ਜਾਣਕਾਰੀ ਨਾ ਹੋਣ ਕਰਕੇ ਹੀ ਉਹ ਗਲਤ ਕਦਮ ਚੁੱਕਦੇ ਹਨ